ਅੱਜ ਮੈਂ ਸਵੇਰੇ ਨੌਂ ਵਜੇ ਭੰਗੜਾ ਅਤੇ ਐਰੋਬਿਕਸ ਕਲਾਸ ਵਿੱਚ ਗਈ ਅਸੀਂ ਬਹੁਤ ਜ਼ਿਆਦਾ ਮਤਲਬ ਉੱਥੇ ਆਨੰਦ ਪਾਇਆ ਸਾਰਿਆਂ ਨੇ ਹੱਸ ਖੇਡ ਕੇ ਸਾਰੇ ਲੋਟ ਪੋਟ ਹੋ ਗਏ ਅਤੇ ਅਸੀਂ ਦੋ ਘੰਟੇ ਪਾਰਟੀ ਕੀਤੀ ਫਿਰ ਸਲਾਦ ਖਾਦਾ ਸਾਰਿਆਂ ਨੇ ਹੱਸਾਂ ਖੇਡਾਂ ਵਾਲੀਆਂ ਗੱਲਾਂ ਕੀਤੀਆਂ ਹੈਲਦੀ ਚੀਜ਼ਾਂ ਖਾਦੀਆਂ ਅਤੇ ਫਿਰ ਅਸੀਂ ਉਸ ਤੋਂ ਬਾਅਦ ਦੋ ਘੰਟੇ ਭੰਗੜਾ ਕੀਤਾ ਫਿਰ ਅਸੀਂ ਗੱਲਾਂ ਬਾਤਾਂ ਕੀਤੀਆਂ ਉਸ ਤੋਂ ਬਾਅਦ ਅਸੀਂ ਫਿਰ ਐਰੋਬਿਕਸ ਕਲਾਸ ਕੀਤੀ ਛੋਟੇ ਵੱਡੇ ਬੱਚੇ ਜਵਾਨ ਸਾਰਿਆਂ ਨੇ ਅਗਰ ਇਹ ਸਾਰੇ ਇੱਦਾਂ ਹੀ ਐਰੋਬਿਸ ਅਤੇ ਭੰਗੜਾ ਕਰਦੇ ਰਹਿਣਗੇ ਘੰਟਾ ਕੱਢੋ ਭਾਵੇਂ ਤੁਸੀਂ ਅੱਧਾ ਘੰਟਾ ਰੋਜ਼ ਦਾ ਕੱਢੋ ਇਹਦੇ ਨਾਲ ਤੁਹਾਡਾ ਦਿਮਾਗ ਵੀ ਸੈਟ ਹੋਵੇਗਾ ਜਿੱਦਾਂ ਲੋਕ ਡਿਪਰੈਸ਼ਨ 'ਚ ਜਾਂਦੇ ਪਏ ਨੇ ਉਹ ਵੀ ਪੜ੍ਹਾਈ 'ਚ ਵੀ ਬੱਚਿਆਂ ਦਾ ਦਿਮਾਗ ਤੇਜ਼ ਹੋਵੇਗਾ ਅਤੇ ਸਰੀਰਕ ਵਿਕਾਸ ਵੀ ਹੋਵੇਗਾ ਇਹਦੇ ਨਾਲ ਸਾਡਾ ਇੰਡੀਆ ਬਿਮਾਰੀਆਂ ਤੋਂ ਵੀ ਪਰੇ ਰਹੇਗਾ ਅਤੇ ਜਿਹੜੀਆਂ ਗੰਦੀਆਂ ਮੁੰਦੀਆਂ ਦਵਾਈਆਂ ਲੱਗੀਆਂ ਹੋਈਆਂ ਲੋਕਾਂ ਨੂੰ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਟੈਂਸ਼ਨ ਹੈ ਉਹਨਾਂ ਦੀਆਂ ਸਾਰੀਆਂ ਟੈਂਸ਼ਨਾਂ ਖਤਮ ਹੋ ਜਾਣਗੀਆਂ ਅਤੇ ਸਾਰਿਆਂ ਨੂੰ ਸਾਨੂੰ ਚਾਹੀਦਾ ਕਿ ਹਰ ਰੋਜ਼ ਐਰੋਬਿਕਸ ਅੱਧਾ ਘੰਟਾ ਅਤੇ ਭੰਗੜਾ ਅੱਧਾ ਘੰਟਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹੇ ਅਸੀਂ ਖੁਸ਼ਹਾਲ ਰਹੀਏ ਧੰਨਵਾਦ ਜੀ